ਬਜ਼ੁਰਗ ਲੋਕ ਜਿਹੜੇ ਕਿ ਇਹ ਹਨ ਉਹ ਕੀ ਕਰਦੇ ਨੇ ਉਹ ਪਿੱਪਲਾਂ ਦੀ ਛਾਵਾਂ ਹੇਠ ਬੈਠ ਕੇ ਤਾਸ਼ਾਂ ਖੇਡਦੇ ਹਨ ਹਾਸੀ ਮਖੌਲ ਕਰਦੇ ਹਨ ਅਤੇ ਖੇ ਤਾਸ਼ ਖੇਡਦੇ ਟਾਈਮ ਉਹ ਗੱਲਾਂ ਦੇ ਨਾਲ ਨਾਲ ਆਪਣੀ ਤਾਸ਼ ਖੇਡਣ ਨਾਲ ਗੱਲਾਂ ਕਰ ਤਾਸ਼ਾਂ ਖੇਡਦੇ ਹਨ ਅਤੇ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਜਿਹੜੀਆਂ ਬੀਬੀਆਂ ਹੁੰਦੀਆਂ ਹਨ ਉਹ ਕਿ ਉਹ ਕਢਾਈ ਸਿਲਾਈ ਮੰਜਾ ਬੁਣਨਾ ਆਦਿ ਦੀਆਂ ਖੇਡਾਂ ਖੇਡਦੀਆਂ ਹਨ ਕਿਉਂਕਿ ਉਹਨਾਂ ਦੇ ਟਾਈਮ ਦੇ ਵਿੱਚ ਇਹੀ ਵਧੀਆ ਖੇਡਾਂ ਖੇਡੀਆਂ ਜਾਂਦੀਆਂ ਸੀ ਮੰਜਾ ਬੁਣਨਾ ਸਿਲਾਈ ਕਢਾਈ ਫੁਲਕਾਰੀ ਕੱਢਣਾ ਅਤੇ ਹੋਰ ਆਦਿ ਬਹੁਤ ਸਾਰੀਆਂ ਗੇ ਖੇਡਾਂ ਜਿਹੜੀਆਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਥੋੜ੍ਹਾ ਟਾਈਮ ਕੱਢ ਕੇ ਇਹ ਖੇਡਦੀਆਂ ਸਨ ਜਦੋਂ ਉਹ ਖੇਡਦੀਆਂ ਤਾਂ ਉਹ ਇੱਕ ਤਰ੍ਹਾਂ ਨਾਲ ਬੱਚਿਆਂ ਦੀ ਤਰ੍ਹਾਂ ਖੇਡਦੀਆਂ ਹਨ ਨਾ ਕਿ ਅਤੇ ਬਜ਼ੁਰਗ ਆਪਣੀ ਤਾਸ਼ਾਂ ਖੇਡਦੇ ਹੋਏ ਨਾਲੇ ਗੱਲਾਂ ਕਰਦੇ ਨੇ ਠੰਡੀਆਂ ਹਵਾਵਾਂ ਦਾ ਆਨੰਦ ਲੈਂਦੇ ਲੈਂਦੇ ਹਨ ਅਤੇ ਨਾਲ ਹੀ ਆ ਆਨੰਦ ਲੈਂਦੇ ਹੋਏ ਨਾਲ ਹੀ ਉਹ ਆਪਣੇ ਤਾਸ਼ਾਂ ਅਤੇ ਤਾਸ਼ਾਂ ਦਾ ਆਨੰਦ ਮਾਣਦੇ ਹਨ ਅਤੇ ਬੀਬੀਆਂ ਫੁਲਕਾਰੀ ਮੰਜਾ ਕੱ ਮੰਜਾ ਬੁਣਨਾ ਫੁਲਕਾਰੀ ਕੱਢਣਾ ਕਢਾਈ ਸਿਲਾਈ ਸਾਰਾ ਉਹ ਕੰਮ ਕਰਕੇ ਆਪਣਾ ਦਿਨ ਦਾ ਮਨੋਰੰਜਨ ਕਰਦੀਆਂ ਹਨ ਅਤੇ ਨਾਲ ਹੀ ਹਾਸੀ ਮਜ਼ਾਕ ਵੀ ਕਰਦੀਆਂ ਹਨ ਤਾਂ ਜੋ ਉਹਨਾਂ ਦਾ ਦਿਨ ਵੀ ਵਧੀਆ ਲੰਘ ਸਕੇ ਅਤੇ ਉਹ ਕੰਮ ਦੇ ਵਿੱਚ ਵੀ ਚੁਸਤ ਰਹਿ ਸਕਣ